ਪੇਂਡੂ ਖੇਤਰਾਂ ਦੇ ਵਿੱਚ ਜੇਕਰ ਸ਼ਾਸੀ ਸਰਕਾਰੀ ਸ਼ਾਸਨ ਵਿੱਚ ਜਿਹੜੇ ਘਾਟ ਆ ਜਿਹੜੀ ਉਹਦੇ ਜੇ ਕਾਰਨ ਦੇਖੀਏ ਸਭ ਤੋਂ ਜ਼ਿਆਦਾ ਤਾਂ ਮੈਨੂੰ ਸਿਹਤ ਪ੍ਰਤੀ ਲੱਗਦਾ ਵੀ ਜਿਵੇਂ ਕਿ ਮੰਨ ਲਓ ਰਾਤ ਨੂੰ ਕਿਸੇ ਦੀ ਸਿਹਤ ਖਰਾਬ ਹੋ ਜਾਂਦੀ ਪਿੰਡ ਦੇ ਵਿੱਚ ਅਤੇ ਸ਼ਹਿਰ ਉਥੋਂ ਕਾਫੀ ਦੂਰ ਆ ਸੋ ਉਹਨਾਂ ਨੂੰ ਇਹੋ ਜਿਹੀ ਜਿਹੜੀਆਂ ਫੈਸਲਿਟੀ ਮਿਲਣੀ ਚਾਹੀਦੀ ਆ ਪਿੰਡ ਦੇ ਵਿੱਚ ਵੀ ਰਾਤ ਨੂੰ ਜਿਹੜਾ ਐਮਰਜੈਂਸੀ ਕੋਈ ਨਾ ਕੋਈ ਇਹੋ ਜਿਹੀ ਸਹੂਲਤ ਮਿਲ ਸਕੇ ਲੋਕਾਂ ਨੂੰ ਕਿ ਉਹਨਾਂ ਨੂੰ ਦੂਰ ਨਹੀਂ ਨਾ ਜਾਣਾ ਪਵੇ ਪਿੰਡ ਦੇ ਵਿੱਚ ਹੀ ਮਿਲ ਮਿਲ ਸਕੇ ਦੂਜੀ ਜਿਹੜੀ ਆ ਪਿੰਡਾਂ ਦੇ ਵਿੱਚ ਜਿਹੜਾ ਨਸ਼ੇ ਉੱਤੇ ਸਰਕਾਰ ਨੂੰ ਚਾਹੀਦਾ ਕਿ ਨਸ਼ਾ ਜਿਹੜਾ ਵੱਧ ਤੋਂ ਵੱਧ ਕੰਟਰੋਲ ਹੋਵੇ ਕਿਉਂਕਿ ਇਹ ਨਸ਼ਾ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਆ ਰਿਹਾ ਜਿਹਦੇ ਵਿੱਚ ਪੰਜਾਬ ਦੀ ਨੌਜਵਾਨੀ ਜਿਹੜੀ ਪੂਰੀ ਤਰ੍ਹਾਂ ਤਬਾਹ ਹੋ ਰਹੀ ਆ ਕਿਉਂਕਿ ਇਹਦੇ ਉੱਤੇ ਵੀ ਜਿਹੜੀ ਸਰਕਾਰ ਨੂੰ ਚਾਹੀਦਾ ਆ ਕਿ ਸਖਤੀ ਥੋੜ੍ਹੀ ਜਿਹੀ ਕਰਨੀ ਚਾਹੀਦੀ ਆ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਆ ਲੋਕ ਨਸ਼ਾ ਵੇਚਦੇ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਜਾਂ ਲੋਕ ਰੋਕ ਨਹੀਂ ਸਕਦੇ ਹੈਗੇ ਕਿਹੜੇ ਆ ਸੋ ਸਰਕਾਰ ਨੂੰ ਇਹਦੇ ਉੱਤੇ ਵੀ ਸਖਤੀ ਚਾਹੀਦੀ ਆ ਜਿੱਥੋਂ ਤੱਕ ਸਮਾ ਸਮਾਜਿਕ ਸ਼ਾਂਤੀ ਦੀ ਗੱਲ ਕਰੀਏ ਸਮਾਜਿਕ ਸ਼ਾਂਤੀ ਤਕਰੀਬਨ ਲਗਭਗ ਸਮਾਜ ਜਿਹੜਾ ਉਹ ਫਿਰ ਵੀ ਠੀਕ ਹੈ ਲਗਭਗ ਸ਼ਹਿਰਾਂ ਦੇ ਨਾਲੋਂ ਆਪਸੀ ਸਾਂਝ ਫਿਰ ਵੀ ਭਾਈਚਾਰਕ ਹੈਗੀ ਆ ਮਾੜੀ ਮੋਟੀ ਪਰ ਜੇ ਰਾਜਨੀਤੀ ਜਿਹੜੇ ਕਰਦੇ ਆ ਉਹਨਾ ਵਾਸਤੇ ਥੋੜ੍ਹੀ ਜਿਹੀ ਮੁਸ਼ਕਿਲ ਆ ਕਿਉਕਿ ਜਿਹੜੇ ਰਾਜਨੀਤਿਕ ਬੰਦੇ ਆ ਉਹ ਜਿਹੜੇ ਆ ਪਿੰਡਾਂ ਦੇ ਵਿੱਚ ਜ਼ਿਆਦਾਤਰ ਰਾਜਨੀਤੀ ਦੇ ਹੀ ਨਤੀਜੇ ਦੇਖਿਆ ਕਿ ਇੱਕ ਦੂਜੇ ਦੇ ਵੈਰ ਵਿਰੋਧ ਭਾਵਨਾ ਜ਼ਿਆਦਾ ਆ ਕੇਸ ਵਗੈਰਾ ਚੱਲਦੇ ਆ ਸੋ ਰਾਜਨੀਤਿਕ ਤੌਰ ਦੇ ਉੱਤੇ ਵੀ ਕੰਟਰੋਲ ਚਾਹੀਦਾ ਕਿ ਇਹੋ ਜਿਹਾ ਭਰਾ ਮਾਰੂ ਜੰਗ ਜਿਹੜੀ ਆ ਲੋਕ ਨਾ ਕਰ ਸਕਣ ਥੋੜ੍ਹੀ ਜਿਹੀ ਇਹਦੇ ਵਿੱਚ ਥੋੜ੍ਹਾ ਜਿਹਾ ਪਿਆਰ ਰਾਜਨੀਤਿਕ ਭਾਵਨਾ ਦੇ ਵਿੱਚ ਪਿਆਰ ਜ਼ਰੂਰ ਪੈਦਾ ਹੋਵੇ ਕਿ ਇੱਕ ਦੂਜੇ ਦੇ ਨਾਲ ਵੈਰ ਵਿਰੋਧ ਨਾ ਪੈਦਾ ਹੋਵੇ